ਖੇਤੀਬਾੜੀ ਅਤੇ ਕਿਸਾਨ ਕਿਸਾਨਾਂ ਲਈ ਭਾਈਚਾਰੇ ਦਾ ਸਮਰਥਨ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਕਿਸਾਨਾਂ ਦੀ ਮਦਦ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ ਜਿਵੇਂ ਨਹਿਰਾਂ ਦਾ ਪਾਣੀ ਫਸਲਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਜਿਵੇਂ ਫਸਲ ਫਸਲ ਦੇ ਕੁਦਰਤੀ ਆਫਤ ਨਾਲ ਖਰਾਬ ਹੋਣ 'ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੀਆਂ ਫਸਲਾਂ ਨੂੰ ਵੱਧ ਤੋਂ ਵੱਧ ਉਪਜਾਊ ਬਣਾ ਸਕਣ ਗਰੀਬ ਕਿਸਾਨ ਨੂੰ ਫਸਲ ਦੀ ਪਨੀਰੀ ਜਾਂ ਖਾਦ ਦੇ ਕੇ ਮਦਦ ਕ ਕਰ ਸਕਦੇ ਹਾਂ ਗਰੀਬ ਕਿਸਾਨਾਂ ਗਰੀਬ ਕਿਸਾਨ ਪੈਸੇ ਦੀ ਮਦਦ ਕਰ ਸਕਦੇ ਹਾਂ ਸਰਕਾਰ ਵੱਲੋਂ ਨਵੀਆਂ ਨਵੀਆਂ ਕਾਢਾਂ ਕੱਢੀਆਂ ਜਾਣੀਆਂ ਕੱਢੀਆਂ ਜਾਂਦੀਆਂ ਹਨ ਉਹਨਾਂ ਦੀ ਵੀ ਪੂਰੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣੀ ਚਾਹ ਚਾਹੀਦੀ ਹੈ ਕਿਸਾਨਾਂ ਨੂੰ ਨਵੇਂ ਨਵੇਂ ਔਜ਼ਾਰ ਅਤੇ ਉਹਨਾਂ ਨੂੰ ਚਲਾਉਣ ਦਾ ਤਰੀਕਾ ਵੀ ਦੱਸਣਾ ਚਾਹੀਦਾ ਹੈ ਸਰਕਾਰ ਵੱਲੋਂ ਆਈਆਂ ਨਵੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦ ਦੇਣੀ ਚਾਹੀਦੀ ਹੈ